ਮੈਨੂੰ ਚਿੱਤਰਕਾਰੀ ਦਾ ਬੜਾ ਸ਼ੌਕ ਆ ਅਤੇ ਜਦੋਂ ਵੀ ਮੈਂ ਕਿਤੇ ਵੀ ਘੁੰਮਣ ਜਾਂਦਾ ਤਾਂ ਉੱਥੇ ਜਦੋਂ ਵੀ ਕੋਈ ਆਰਟਵਰਕ ਦੇਖਦਾ ਹਾਂ ਤਾਂ ਮੈਂ ਉਹਦੀ ਚਿੱਤਰਕਾਰੀ ਕਰਨ ਦੀ ਕੋਸ਼ਿਸ਼ ਕਰਦਾ ਹਾਂ ਅਤੇ ਮੈਂ ਜਦੋਂ ਵੀ ਕਿਤੇ ਘੁੰਮਣ ਜਾਂਦਾ ਤਾਂ ਮੈਂ ਅਕਸਰ ਹੀ ਫੋਟੋਆਂ ਖਿੱਚ ਕੇ ਲੈ ਕੇ ਆਉਂਦਾ ਅਤੇ ਬਾਅਦ 'ਚੋਂ ਘਰ ਆ ਕੇ ਉਹਦੀ ਬੈਠ ਕੇ ਪੇਂਟਿੰਗ ਕਰਦਾ ਅਤੇ ਕਈ ਵਾਰ ਪੇਂਟਿੰਗ ਕਰਨ ਦੇ ਵਿੱਚ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਅਤੇ ਇੱਕ ਇਹੋ ਜਿਹੀ ਪੇਂਟਿੰਗ ਮੈਂ ਬਣਾਈ ਸੀ ਜੋ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸੀ ਇਹ ਉਦੋਂ ਸੀ ਜਦੋਂ ਮੈਂ ਚੱਪੜ ਚਿੜੀ ਗਿਆ ਸੀ ਤਾਂ ਮੈਂ ਚੱਪੜ ਚਿੜੀ ਬਾਬਾ ਬੰਦਾ ਸਿੰਘ ਬਹਾਦਰ ਦਾ ਇੱਕ ਬਹੁਤ ਹੀ ਵਧੀਆ ਸਟੈਚੂ ਦੇਖਿਆ ਸੀ ਜਦੋਂ ਮੈਂ ਸਟੈਚੂ ਦੇਖਿਆ ਤਾਂ ਮੈਂ ਉਹਦੀ ਇੱਕ ਵਧੀਆ ਜਿਹੀ ਫੋਟੋ ਕਲਿਕ ਕੀਤੀ ਅਤੇ ਉਹ ਬਾਅਦ 'ਚੋਂ ਮੈਂ ਘਰ ਆ ਕੇ ਉਸ ਦੀ ਪੇਂਟਿੰਗ ਕੀਤੀ ਮੈਨੂੰ ਯਾਦ ਆ ਕਿ ਮੈਂ ਨੌਂ ਘੰਟਿਆਂ ਦੇ ਵਿੱਚ ਉਹ ਪੇਂਟਿੰਗ ਤਿਆਰ ਕੀਤੀ ਸੀ ਅਤੇ ਉਹ ਪੇਂਟਿੰਗ ਮੈਂ ਦਿਨ ਅਤੇ ਰਾਤ ਲਾ ਕੇ ਤਿਆਰ ਕੀਤੀ ਸੀ ਕਿਉਂਕਿ ਮੈਂ ਉਹਦੇ ਵਿੱਚ ਬਹੁਤ ਜ਼ਿਆਦਾ ਬਰੀਕ ਡਿਟੇਲਸ ਬਣਾਈਆਂ ਸੀ ਜਿਹਦੇ ਕਰਕੇ ਪੇਂਟਿੰਗ ਬਿਲਕੁਲ ਅਸਲੀ ਲੱਗ ਰਹੀ ਸੀ ਅਤੇ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਜਦੋਂ ਮੈਂ ਪੇਂਟਿੰਗ ਪੂਰੀ ਕੀਤੀ ਅਤੇ ਇਹ ਪੇਂਟਿੰਗ ਮੈਂ ਇੰਟਰਨੈਟ 'ਤੇ ਵੀ ਸਾਂਝੀ ਕੀਤੀ ਅਤੇ ਇਹ ਪੇਂਟਿੰਗ ਬਹੁਤ ਲੋਕਾਂ ਨੂੰ ਪਸੰਦ ਆਈ ਅਤੇ ਲੋਕਾਂ ਨੇ ਬਹੁਤ ਵਧੀਆ ਕਮੈਂਟ ਕੀਤੇ